ਫ਼ਸਲਾਂ ਲਈ ਸਾਰਾ ਸਾਲ ਘੱਟ ਤੋਂ ਘੱਟ ਪੰਜਾਬ ਵਿੱਚ ਚਾਰ ਜਾਂ ਪੰਜ ਮੌਸਮ ਆਉਂਦੇ ਆ ਤੇ ਉਹ ਸਾਰੀਆਂ ਵੱਖਰੋਂ ਵੱਖਰੀਆਂ ਫ਼ਸਲਾਂ ਲਈ ਲਾਹੇਵੰਦ ਹੁੰਦੇ ਆ ਸਰਦੀਆਂ ਵਿੱਚ ਕਣਕ ਸਰੋਂ ਛੋਲੇ ਇਸੇ ਤਰ੍ਹਾਂ ਗਰਮੀਆਂ ਵਿੱਚ ਧਾਨ ਜਾਂ ਨਰਮਾ ਜਿਹਨੂੰ ਅਸੀਂ ਜੀਰੀ ਬੋਲਦੇ ਹਾਂ ਧਾਨ ਨੂੰ ਇਹ ਹੁੰਦੀਆਂ ਜੇ ਜ਼ਿਆਦਾ ਗਰਮੀ ਪੈ ਜੇ ਬੇਹੱਦ ਗਰਮੀ ਤਾਂ ਉਹ ਇਹਦੇ ਲਈ ਵੀ ਮਾੜੀ ਹੁੰਦੀ ਹੈ ਪ੍ਰੰਤੂ ਜੇ ਬਹੁਤ ਜ਼ਿਆਦਾ ਬਰਸਾਤ ਹੋ ਜਾਂਦੀ ਹੈ ਫਿਰ ਵੀ ਮਾੜੀ ਹੋ ਜਾਂਦੀ ਹੈ ਹਮੇਸ਼ਾ ਮੌਸਮ ਦਰਮਿਆਨਾ ਹੀ ਰਹੇ ਫਿਰ ਫ਼ਸਲਾਂ ਜ਼ਿਆਦਾ ਚੰਗੀਆਂ ਹੁੰਦੀਆਂ ਕਣਕ ਨੂੰ ਬਹੁਤ ਜ਼ਿਆਦਾ ਗਰਮੀ ਬੇਹੱਦ ਠੰਡ ਇਹ ਵੀ ਨੁਕਸਾਨ ਹੀ ਕਰਦੀਆਂ ਉਝ ਠੰਡ ਕਣਕ ਦੀ ਫ਼ਸਲ ਲਈ ਅੱਛੀ ਹੁੰਦੀ ਹੈ